ਕਲਾ ਅਤੇ ਸ਼ਿਲਪਕਾਰੀ ਸਾਡੀ ਪਰੰਪਰਾਵਾਂ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ ਇਹ ਸਾਨੂੰ ਸਾਡੇ ਸੱਭਿਆਚਾਰ ਬਾਰੇ ਦਰਸਾਉਂਦੀਆਂ ਹਨ ਅਤੇ ਇਹ ਸਾਨੂੰ ਸਾਡੇ ਵਿਰਾਸਤ ਵਿੱਚ ਮਿਲੀਆਂ ਹਨ ਜਿਵੇਂ ਕਿ ਘੁਮਿਆਰ ਮਿੱਟੀ ਨੂੰ ਆਪਣੀ ਕਲਾ ਨਾਲ ਘੜੇ ਦਾ ਰੂਪ ਦਿੰਦਾ ਹੈ ਅਤੇ ਉਸ ਉੱਤੇ ਆਪਣੀ ਸ਼ਿਲਪਕਾਰੀ ਨਾਲ ਉਸ ਘੜੇ ਦੀ ਮਹੱਤਤਾ ਵਧਾਉਂਦਾ ਹੈ ਕਲਾ ਅਤੇ ਸ਼ਿਲਪਕਾਰੀ ਸਾਡੀ ਚਿੰਨ੍ਹਾਂ ਵਿੱਚ ਵੀ ਵਰਤੇ ਜਾਂਦੇ ਹਨ ਕਲਾ ਅਤੇ ਸ਼ਿਲਪਕਾਰੀ ਨੂੰ ਅਸੀਂ ਆਪਣੇ ਧਾਰਮਿਕ ਧਾਰਮਿਕ ਸੰਸਥਾਵਾਂ 'ਤੇ ਵੀ ਵਰਤਦੇ ਹਾਂ ਕਲਾ ਅਤੇ ਸ਼ਿਲਪਕਾਰੀ ਨੂੰ ਅਸੀਂ ਆਪਣੇ ਸੜਕਾਂ ਉੱਤੇ ਵੀ ਦਰਸਾਉਂਦੇ ਹਾਂ ਕਈ ਚਿੰਨ੍ਹਾਂ ਵਿੱਚ ਵੀ ਅਸੀਂ ਕਲਾ ਅਤੇ ਸ਼ਿਲਪਕਾਰੀ ਰਾਹੀਂ ਕਈ ਸੰਕੇਤਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ ਕਲਾ ਅਤੇ ਸ਼ਿਲਪਕਾਰੀ ਦਾ ਸਾਡੇ ਜੀਵਨ ਵਿੱਚ ਬੜਾ ਹੀ ਅਹਿਮ ਮੁੱਲ ਹੈ ਇਸ ਵਿੱਚ ਕਈ ਤਰ੍ਹਾਂ ਦੀ ਕਵਿਤਾਵਾਂ ਵੀ ਅਸੀਂ ਕਲਾ ਰਾਹੀਂ ਅਤੇ ਚਿੱਤਰਕਾਰੀ ਰਾਹੀਂ ਦਰਸਾਉਂਦੇ ਹਾਂ